ਨਮਸਤੇ ਸਰ ਮੈਂ ਨਾ ਪੱਚੀ ਨਵੰਬਰ ਦੋ ਹਜ਼ਾਰ ਤੇਈ ਨੂੰ ਇੱਕ ਔਡਰ ਪਲੇਸ ਕਰਕੇ ਆਈ ਸੀਗੀ ਮਾਲਵਾ ਸਵੀਟਸ 'ਤੇ ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਸ ਦਿਨ ਮੇਰੇ ਬ ਬ੍ਰਦਰ ਦਾ ਬਰਡੇ ਹੈ ਉਹਦੇ ਲਈ ਸਾਨੂੰ ਸਾਰਾ ਸਮਾਨ ਚਾਹੀਦਾ ਸੀਗਾ ਸਵੀਟਸ ਵਗੈਰਾ ਵੀ ਦਾ ਵੀ ਔਡਰ ਕੀਤਾ ਹੋਇਆ ਸੀਗਾ ਅਤੇ ਕੇਕ ਸੀਗਾ ਇੱਕ ਅਤੇ ਡਿਨਰ ਦਾ ਵੀ ਕਿਹਾ ਹੋਇਆ ਸੀਗਾ ਸ਼ਾਮ ਦੇ ਡਿਨਰ ਦਾ ਵੀ ਇੰਨੇ ਵਜੇ ਤੱਕ ਸਾਡੀ ਡਿਲੀਵਰੀ ਕਰ ਦਿਓ ਬਟ ਉਹ ਮੈਨੂੰ ਨਾ ਕੈਂਸਲ ਕਰਨਾ ਸੀਗਾ ਅਤੇ ਕੈਂਸਲ ਵੀ ਕੀ ਕਰਨਾ ਸੀਗਾ ਕੈਂਸਲ ਨਹੀਂ ਕਰਨਾ ਸੀ ਉਹਦੀ ਲੋਕੇਸ਼ਨ ਚੇਂਜ ਕਰਨੀ ਸੀਗੀ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਉਹਦਾ ਅਡਰੈੱਸ ਮੈਂ ਤੁਹਾਨੂੰ ਸ਼ਹਿਰ ਦਾ ਦਿੱਤਾ ਹੋਇਆ ਸੀਗਾ ਖਮਾਣੋ ਸ਼ਹਿਰ ਦਾ ਪਰ ਉਹ ਨਾ ਸਾਨੂੰ ਇੱਕ ਵਿਲੇਜ ਦੇ ਵਿੱਚ ਚਾਹੀਦਾ ਸੀਗਾ ਪੋਲੋ ਮਾਜਰੇ ਤੁਸੀਂ ਉੱਥੇ ਉਹਦੀ ਡਿਲੀਵਰੀ ਕਰ ਸਕਦੇ ਹੋ ਉਣੱਤੀ ਸਤੰਬਰ ਦੋ ਹਜ਼ਾਰ ਤੇਈ ਨੂੰ ਉਹਦੀ ਡਿਲੀਵਰੀ ਚਾਹੀਦੀ ਸੀਗੀ ਇਸ ਲਈ ਮੈਂ ਤੁਹਾਨੂੰ ਕੋਲ ਕੀਤੀ ਸੀਗੀ ਵੀ ਅਗਰ ਪੋਸੀਬਲ ਹੋ ਸਕਦਾ ਹੈਗਾ ਤਾਂ ਉਹਦੀ ਡਿਲੀਵਰੀ ਆ ਜਿਹੜੀ ਤੁਸੀਂ ਉਹ ਪਹਿਲਾਂ ਵਾਲੀ ਲੋਕੇਸ਼ਨ ਦੀ ਚੇਂਜ ਕਰਕੇ ਨਵੀਂ ਜਿਹੜੀ ਲੋਕੇਸ਼ਨ ਦੱਸੀ ਹੈ ਮੈਂ ਹੁਣ ਉਹਦੇ 'ਤੇ ਕਰ ਦਿਓ ਕਿਉਂਕਿ ਇਹਦੇ ਵਿੱਚ ਸਾਡੇ ਬ੍ਰ ਘਰੇ ਹੈ ਨਹੀਂ ਸੀਗੇ ਕੋਈ ਜਿਹੜੇ ਉਹ ਸਮਾਨ ਖਮਾਣੋ ਤੋਂ ਆ ਕੇ ਲੈ ਕੇ ਜਾ ਸਕਣ ਜਾਂ ਉੱਥੇ ਤੁਸੀਂ ਡਿਲੀਵਰੀ ਕਰਨੀ ਸੀਗੀ ਇਸ ਲਈ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਤੁਸੀਂ ਪਲੀਜ਼ ਪੋਲੋ ਮਾਜਰੇ ਕਰ ਦਿਓ ਅਤੇ ਉੱਥੇ ਅਸੀਂ ਕੰਫਰਟੇਬਲੀ ਕੋਈ ਵੀ ਲੈ ਕੇ ਜਾ ਸਕਦਾ ਏ ਆ ਜਿਹੜੇ ਤੁਸੀਂ ਪਲੇਸ ਕਰੋਂਗੇ ਔਡਰ ਅਤੇ ਟਾਈਮਲੀ ਇਹ ਨਾ ਸਾਰਾ ਔਡਰ ਪਲੇਸ ਕਰ ਦਿਓ ਕਿਉਂਕਿ ਸਾਨੂੰ ਸਾਰਾ ਸਮਾਨ ਨੌ ਕੁ ਵਜੇ ਤੱਕ ਚਾਹੀਦਾ ਸੀਗਾ ਸਾਰੇ ਸਾਨੂੰ ਜਿਹੜੇ ਰਲੇਟਿਵਸ ਨੇ ਗੇ ਸਾਰੇ ਉਹਨਾਂ ਨੇ ਨੌ ਕੁ ਵਜੇ ਤੱਕ ਪਹੁੰਚ ਜਾਣਾ ਪਲੀਜ਼ ਇਸ ਕਰਕੇ ਇਹਨੂੰ ਟਾਈਮ ਟੂ ਟਾਈਮ ਪਹੁੰਚਾ ਦਿਓ ਡਿਲੀਵਰੀ ਨੂੰ ਅਤੇ ਪਲੀਜ਼ ਐਡਰੈੱਸ ਦਾ ਤੁਸੀਂ ਦੇਖ ਲਿਓ ਇੱਕ ਵਾਰ ਚੈੱਕ ਕਰ ਲਿਓ ਕਿਉਂਕਿ ਮੈਂ ਪਹਿਲਾਂ ਖਮਾਣੋ ਦਾ ਅਡਰੈੱਸ ਲਿਖਵਾਇਆ ਹੋਇਆ ਸੀਗਾ ਹੁਣ ਇਹ ਅਡਰੈੱਸ ਮੈਂ ਚੇਂਜ ਕਰਕੇ ਪੋਲੋ ਮਾਜਰੇ ਦਾ ਲਿਖਵਾ ਤਾ ਉੱਥੇ ਕਰ ਦਿਓ ਠੀਕ ਹੈ ਜਦੋਂ ਤੁਸੀਂ ਆਵੋਗੇ ਜਦੋਂ ਡਿਲੀਵਰੀ ਦੇਣ ਕੋਈ ਵੀ ਬੋਆਏ ਨੂੰ ਭੇਜੋਗੇ ਤਾਂ ਉਹਨੂੰ ਨਾ ਨੰਬਰ ਦ ਦੱਸ ਦਿਓ ਨਾਈਨ ਏਟ ਵੰਨ ਫੋਰ ਸੈਵਨ ਥ੍ਰੀ ਸਿਕਸ ਵੰਨ ਸਿਕਸ ਥ੍ਰੀ ਇਸ ਨੰਬਰ 'ਤੇ ਕੋਲ ਕਰਕੇ ਪੁੱਛ ਲੂਗਾ ਵੀ ਤੁਸੀਂ ਕਿੱਥੇ ਹੋ ਜਾਂ ਉਹਨਾਂ ਨੂੰ ਸਾਰੀਆਂ ਡਰੈਕਸ਼ਨਸ ਅਸੀਂ ਦੇ ਦਾਂਗੇ ਜਾਂ ਫਿਰ ਉਹਨਾਂ ਨੂੰ ਲਾਈਵ ਲੋਕੇਸ਼ਨ ਭੇਜ ਦਾਂਗੇ ਜਿੱਥੇ ਉਹਨਾਂ ਨੇ ਡਿਲੀਵਰੀ ਕਰਨੀ ਹੈ